ਇਹ ਪ੍ਰਸ਼ਨ ਬੜਾ ਵਾਜਿਬ ਹੈ ਕਿ ਮੀਡੀਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਨੂੰ ਉਚਿੱਤ ਰੂਪ ਵਿੱਚ ਦਰਸਾਇਆ ਗਿਆ ਹੈ ਜਾਂ ਨਹੀਂ ਦੇਖੋ ਅਗਰ ਆਪਾਂ ਸਿੱਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬਿਲਕੁਲ ਮੈਂ ਕਹਿ ਸਕਦਾ ਕਿ ਸਾਡੀ ਮਾਤਰ ਭਾਸ਼ਾ ਪੰਜਾਬੀ ਨੂੰ ਇੱਕ ਸਨਮਾਨਜਨਕ ਸਥਾਨ ਜ਼ਰੂਰ ਮਿਲਿਆ ਹੈ ਕਾਰਨ ਕਿ ਪਹਿਲਾਂ ਜਿੰਨੇ ਵੀ ਦਫ਼ਤਰ ਸੀ ਸਰਕਾਰੀ ਅਦਾਰੇ ਸੀ ਉਹਨਾਂ ਵਿੱਚ ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਾਰੇ ਕੰਮ ਅੰਗਰੇਜ਼ੀ 'ਚ ਹੁੰਦੇ ਸੀ ਲੇਕਿਨ ਉਸ ਤੋਂ ਬਾਅਦ ਆਉਣ ਵਾਲੀ ਸਰਕਾਰਾਂ ਨੇ ਧਿਆਨ ਦਿੱਤਾ ਕਿ ਨਹੀਂ ਇਹ ਠੀਕ ਨਹੀਂ ਹੈ ਇੱਦਾਂ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਸਾਡੇ ਵਿਰਸੇ ਨੂੰ ਭੁੱਲਦੇ ਜਾਵਾਂਗੇ ਅਤੇ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਸ਼ਾਇਦ ਆਪਾਂ ਉਹਦੇ ਨਾਲ਼ ਇੱਕ ਅਨਿਆਂਏ ਕਰਾਂਗੇ ਅਤੇ ਇਹ ਉਪਰਾਲਾ ਕੀਤਾ ਗਿਆ ਅਤੇ ਹੁਣ ਕੀ ਹੈ ਕਿ ਪੰਜਾਬ ਵਿੱਚ ਜੋ ਸਰਕਾਰੀ ਅਦਾਰੇ ਨੇ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਜ਼ਰੂਰੀ ਹੈ ਇਹ ਬਹੁਤ ਚੰਗਾ ਫੈਸਲਾ ਹੋਇਆ ਜਿਹਦੇ ਨਾਲ਼ ਪੰਜਾਬੀ ਦੇ ਪ੍ਰਤੀ ਅਸੀਂ ਇੱਕ ਇੱਕ ਹੋ ਕੇ ਇੱਕ ਕਰਜ਼ ਅਦਾ ਕਰ ਪਾ ਰਹੇ ਹਾਂ ਅਸੀਂ ਦੂਜੀ ਗੱਲ ਅਗਰ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਵਿੱਚ ਹਜੇ ਵੀ ਬਹੁਤ ਸਮਾਂ ਲੱਗੇਗਾ ਮੈਂ ਕਹਿ ਸਕਦਾ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਉਹ ਸਨਮਾਨ ਮਿਲ ਸਕੇ ਕਾਰਨ ਕੀ ਹੈ ਜੇ ਤੁਸੀਂ ਜੋ ਇਲੈੱਕਟ੍ਰੋਨਿਕ ਮੀਡੀਆ ਹੈ ਉਹਦੇ ਵਿੱਚ ਪੰਜਾਬੀ ਵਿਸ਼ੇ ਨੂੰ ਲੈ ਕਰਕੇ ਜੋ ਪ੍ਰੋਗਰਾਮ ਦਿਖਾਏ ਜਾਂਦੇ ਹਨ ਜਾਂ ਨਿਊਜ਼ ਵੀ ਦਿਖਾਏ ਜਾਂਦੇ ਐਂ ਇੰਟਰਟੇਨਮੈਂਟ ਜਾਂ ਕੋਈ ਹੋਰ ਟੋਪਿਕ 'ਤੇ ਤਾਂ ਉਹਨਾਂ ਵਿੱਚ ਪੰਜਾਬੀ ਵਿਸ਼ੇ ਨੂੰ ਲੈ ਕਰਕੇ ਕੋਈ ਬਹੁਤੀ ਗੰਭੀਰਤਾ ਦਿਸਦੀ ਨਹੀਂ ਹੁੰਦੀ ਗੱਲ ਅਗਰ ਇੰਟਰਟੇਨਮੈਂਟ ਦੀ ਕਰੀਏ ਤਾਂ ਗਾਣਿਆਂ ਵਿੱਚ ਦੇਖ ਲਓ ਆਪ ਪੰਜਾਬੀ ਗਾਣੇ ਹੈ ਆਖਿਰਕਾਰ ਉਹ ਵੀ ਸਾਡੀ ਪੰਜਾਬੀ ਭਾਸ਼ਾ ਦਾ ਹਿੱਸਾ ਨੇ ਉਹਨਾਂ ਦੇ ਵਿੱਚ ਇੱਕ ਅੰਗਰੇਜ਼ੀ ਦੇ ਸ਼ਬਦਾਂ ਦਾ ਟੱਚ ਤੁਹਾਨੂੰ ਬਹੁਤ ਮਿਲੇਗਾ ਅਸ਼ਲੀਲਤਾ ਵੀ ਬਹੁਤ ਮਿਲੇਗੀ ਜੋ ਕਿ ਸਾਡੀ ਮੀਡੀਆ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕਰਕੇ ਕੋਈ ਸੋਹਣੀ ਗੱਲ ਨਹੀਂ ਹੈ ਫਿਰ ਤੁਸੀਂ ਨਿਊਜ਼ ਐਂਕਰ ਨੂੰ ਦੇਖੋ ਉਹ ਕਿੰਨੇ ਹੀ ਸ਼ਬਦ ਐਸੇ ਬੋਲੇਗੀ ਜੋ ਕਿ ਅੰਗਰੇਜ਼ੀ ਦੇ ਹੋਣਗੇ ਉਰਦੂ ਦੇ ਹੋਣਗੇ ਜਾਂ ਕਹਿ ਲਓ ਕਿ ਹਿੰਦੀ ਦੇ ਵੀ ਹੋਣਗੇ ਅਗਰ ਸੱਚੀ ਵਿੱਚ ਤੁਸੀਂ ਪੰਜਾਬੀ ਭਾਸ਼ਾ ਦਾ ਸਨਮਾਨ ਕਰਨਾ ਚਾਹੁੰਦੇ ਹੋ ਮੀਡੀਆ ਵਿੱਚ ਤਾਂ ਇੱਕ ਪੱਖ ਹੋਰ ਵੀ ਹੈ ਕਿ ਪਹਿਰਾਵਾ ਜਿੰਨੇ ਨਿਊਜ਼ ਐਂਕਰ ਹੈ ਕੋਈ ਪੰਜਾਬੀ ਸੂਟ ਵਿੱਚ ਨਹੀਂ ਆਵੇਗਾ ਤੁਸੀਂ ਦੇਖੋ ਕੋਈ ਅਲੱਗ ਹੀ ਉਹਨਾਂ ਦਾ ਪਹਿਰਾਵਾ ਹੁੰਦਾ ਹੈ ਪਹਿਰਾਵਾ ਅੱਡ ਹੋਣ ਨਾਲ਼ ਹੀ ਪੰਜਾਬੀ ਭਾਸ਼ਾ ਦਾ ਮੀਡੀਆ ਵਿੱਚ ਅਸਥਾਨ ਪ੍ਰਭਾਵਿਤ ਹੁੰਦਾ ਤਾਂ ਮੇਰਾ ਮੱਤ ਹੈ ਕਿ ਬਿਲਕੁਲ ਹੁੰਦਾ ਇਸ ਲਈ ਪੰਜਾਬੀ ਭਾਸ਼ਾ ਨੂੰ ਮੀਡੀਆ ਵਿੱਚ ਉਚਿੱਤ ਅਸਥਾਨ ਮਿਲੇ ਪਹਿਰਾਵੇ ਨੂੰ ਵੀ ਇੱਕ ਪੱਖ ਦੇ ਰੂਪ 'ਚ ਦੇਖਿਆ ਜਾਵੇ ਧੰਨਵਾਦ